ਹੈਲੋ ਹਾਂਜੀ ਮੈਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਮੈਮ ਮੈਂ ਨਾ ਹੁਣੇ ਹੁਣੇ ਪਲੱਸ ਟੂ ਪਾਸ ਆਊਟ ਹੋਇਆ ਜੀ ਅਤੇ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਵੀ ਮੇਰੀ ਆਰਟਸ ਦੇ ਵਿੱਚ ਮੇਰੀ ਸਟਰੀਮ ਹੈ ਮੈਂ ਆਰਟਸ ਵਿੱਚ ਪੜ੍ਹਿਆ ਹੋਇਆ ਤਾਂ ਮੇਰੇ ਲਈ ਕਿਹੜੀ ਕਿਹੜੀਆਂ ਆਪਸ਼ਨਾਂ ਨੇ ਜੀ ਇਸ ਤੋਂ ਬਾਅਦ ਮੈਂ ਕਿਹੜੇ ਕਿਹੜੇ ਕੋਰਸ ਕਰ ਸਕਦਾ

ਲੋਅ ਦੀ ਹਾਂਜੀ ਹਾਂ ਠੀਕ ਹੈ ਜੀ

ਨਹੀਂ ਮੇਰਾ ਤਾਂ ਜੀ ਵੈਸੇ ਇੰਟਰਸਟ ਇਹ ਹੀ ਆ ਕਿ ਮੈਂ ਸਿਵਿਲ ਅਤੇ ਜਾਂ ਫਿਰ ਗੌਮੈਂਟ ਜੋਬ ਦੀ ਤਿਆਰੀ ਕਰਾਂ ਜੀ ਪੇਪਰ ਵਗੈਰਾ ਦੇਣੇ ਨੇ ਅੱਗੇ ਅਤੇ ਮੇਰੇ ਕੋਲ ਪਹਿਲਾਂ ਇਕਨੋਮਿਕਸ ਜੋਗਰਫੀ ਇਹ ਸਬਜੈਕਟ ਸੀਗੇ ਜੀ ਠੀਕ ਹੈ

ਠੀਕ ਹੈ ਜੀ ਠੀਕ ਹੈ ਠੀਕ ਹੈ ਮੈਮ ਠੀਕ ਹੈ ਮੈਮ ਅਤੇ ਮੈਂ ਇੱਕ ਹੋਰ ਪੁੱਛਣਾ ਸੀਗਾ ਕਿ ਆਪਣਾ ਆਈ ਏ ਐੱਸ ਵਗੈਰਾ ਉਹ ਵੀ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਹੈ ਜਿਹੜੀ ਤੁਸੀਂ ਕੋਚਿੰਗ ਦੀ ਗੱਲ ਕਰ ਰਹੇ ਹੋ ਠੀਕ ਹੈ ਠੀਕ ਹੈ ਠੀਕ ਹੈ ਸ਼ੁਕਰੀਆਂ ਮੈਮ ਥੈਂਕ ਯੂ ਸੋ ਮਚ